ਪੰਜਾਬੀ ਸਿੱਖਿਆ ਪ੍ਰਣਾਲੀ ਵਿੱਚ ਸਿੱਖਿਆ ਪ੍ਰਣਾਲੀ ਵਿਦਿਆਰਥੀਆਂ ਨੂੰ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਅਤੇ ਕਰੀਅਰ ਦੇ ਮੌਕਿਆਂ ਲਈ ਬਹੁਤ ਹੀ ਚੰਗੇ ਢੰਗ ਨਾਲ ਤਿਆਰ ਕਰਦੀ ਹੈ ਕਿਉਂਕਿ ਅੱਜ ਕੱਲ੍ਹ ਪੰਜਾਬ ਸਰਕਾਰ ਨੇ ਇਹ ਮੁਹਿੰਮ ਚਲਾਈ ਹੋਈ ਹੈ ਕਿ ਪੰਜਾਬ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਬੱਚਿਆਂ ਨੂੰ ਉੱਚੀ ਸਿੱਖਿਆ ਦੇ ਲਈ ਮਾਰਗਦਰਸ਼ਨ ਪ੍ਰਦਾਨ ਕੀਤਾ ਜਾਵੇ ਅਤੇ ਇਸ ਦਾ ਸਿਰਾ ਅਧਿਆਪਕਾਂ ਦੇ ਸਿਰ 'ਤੇ ਹੈ ਅਤੇ ਕਈ ਤਰ੍ਹਾਂ ਦੇ ਕਾਲਜ ਵੀ ਇਸਦੇ ਲਈ ਖੋਲ੍ਹੇ ਗਏ ਹਨ ਜਿਸ ਦੇ ਵਿੱਚ ਉ ਉੱਥੇ ਇਹ ਦੱਸਿਆ ਜਾਂਦਾ ਹੈ ਕਿ ਕਿਵੇਂ ਬੱਚੇ ਆਪਣੀ ਸਕੈਂਡਰੀ ਐਜੂਕੇਸ਼ਨ ਤੋਂ ਬਾਅਦ ਕਿਸ ਫੀਲਡ ਦੇ ਵਿੱਚ ਜਾ ਸਕਦੇ ਹਨ ਅਤੇ ਜਦੋਂ ਉਹ ਕਾਲਜ ਖਤਮ ਕਰ ਲੈਂਦੇ ਹਨ ਅਤੇ ਉਹਨਾਂ ਨੂੰ ਅਤੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਕੰਮ ਕਿਹੜਾ ਕਰ ਕਰਨਾ ਚਾਹੀਦਾ ਹੈ ਇਸਦੇ ਲਈ ਉਹਨਾਂ ਉਹਨਾਂ ਦੇ ਲਈ ਕੋਰਸਾਂ ਤੋਂ ਬਾਅਦ ਇੰਟਰਨਸ਼ਿਪ ਵੀ ਰੱਖੀ ਜਾਂਦੀ ਹੈ ਤਾਂ ਕਿ ਉਹ ਆਪਣੀ ਆਪਣੇ ਆਪ ਨੂੰ ਯੋਗ ਸਾਬਿਤ ਕਰ ਸਕਣ ਅਤੇ ਅਧਿਆਪਕਾਂ ਦੁਆਰਾ ਉਹਨਾਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਆਪਣੀ ਪੜ੍ਹਾਈ ਦੇ ਨਾਲ ਨਾਲ ਪਾਰਟ ਟਾਈਮ ਜੋਬਸ ਵੀ ਕਰਨ ਜਿਸ ਨਾਲ ਉਹਨਾਂ ਅਤੇ ਉਹਨਾਂ ਦੇ ਮਾਪਿਆਂ ਦਾ ਮਾਪਿਆਂ ਦਾ ਭਾਰ ਵੀ ਥੋੜ੍ਹਾ ਹਲਕਾ ਹੋ ਜਾਵੇ ਕਿਉਂਕਿ ਅੱਜ ਕੱਲ੍ਹ ਪੜ੍ਹਾਈਆਂ 'ਤੇ ਹੀ ਇੰਨਾਂ ਪੈਸਾ ਖਰਚ ਹੋ ਰਿਹਾ ਹੈ ਜੇਕਰ ਉਹ ਪਾਰਟ ਟਾਈਮ ਜੋਬ ਕਰਕੇ ਆਪਣਾ ਖਰਚਾ ਚੁੱਕਦੇ ਹਨ ਤਾਂ ਉਹਨਾਂ ਦੀ ਅਤੇ ਉਹਨਾਂ ਦੇ ਮਾਪਿਆਂ ਦੀ ਬਹੁਤ ਹੀ ਜ਼ਿਆਦਾ ਮਦਦ ਹੋਵੇਗੀ ਇਸ ਕਰਕੇ ਪੰਜਾ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੇ ਰੁਜ਼ਗਾਰ ਨਾਲ ਸੰਬੰਧਿਤ ਰੁਜ਼ਗਾਰ ਮੇਲੇ ਵੀ ਲ ਲਗਾਏ ਜਾਂਦੇ ਹਨ ਜਿਸ ਦੇ ਵਿੱਚ ਸਰਕਾਰ ਦੁਆਰਾ ਇਹ ਦੱਸਿਆ ਜਾਂਦਾ ਹੈ ਕਿ ਕਿਵੇਂ ਕਿ ਕਿਵੇਂ ਅਤੇ ਕਿਸ ਢੰਗ ਨਾਲ ਬੱਚੇ ਆਪਣੇ ਆਪਣੇ ਕਰੀਅਰ ਨੂੰ ਲੈ ਕੇ ਸੁਚੇਤ ਰਹਿਣ